ਗੱਲ ਕਰੀ ਜਾਵੇ ਪੰਜਾਬੀ ਭਾਸ਼ਾ ਦੀ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਹੈ ਅਤੇ ਇਹ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਤਾਂ ਹੈ ਪਰ ਇਹ ਗੁਰੂਆਂ ਦੇ ਮੁਖ ਦੇ ਵਿੱਚੋਂ ਨਿਕਲਣ ਵਾਲੀ ਗੁਰਮੁਖੀ ਤਾਂ ਕਰਕੇ ਕਿਹਾ ਜਾਂਦਾ ਇਸ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਆਉਣ ਵਾਲੇ ਬਾਬਾ ਬੁੱਲੇ ਸ਼ਾਹ ਜੋ ਕਿ ਪੰਜਾਬੀ ਦੇ ਰਚਨਾਤਮਕ ਕਵੀ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਆਏ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਨੇ ਬਾਕੀ ਗੁਰੂਆਂ ਨੇ ਇਹਨੂੰ ਸੁਧਾਰਨ ਦਾ ਕੰਮ ਕੀਤਾ ਇਹ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਹੈ ਇਹਨਾਂ ਦੇ ਇਹ ਇਹ ਭਾਸ਼ਾ ਕਾਫੀ ਭਾਸ਼ਾਵਾਂ ਦਾ ਸੱਭਿਆਚਾਰ ਦੁਆਰਾ ਪ੍ਰਭਾਵਿਤ ਹੋਈ ਜਿਵੇਂ ਕਿ ਇੰਗਲਿਸ਼ ਠੀਕ ਹੈ ਉਹ ਵੈਸਟਰਨ ਕਲਚਰ ਦੇ ਦੌਰਾਨ ਪ੍ਰਭਾਵ ਆਪਣਾ ਉਹ ਆਈ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਪੰਜਾਬ ਦਾ ਜਿਹੜਾ ਇਲਾਕਾ ਸੀ ਠੀਕ ਹੈ ਉਹ ਇੰਡੀਆ ਦਾ ਇਲਾਕਾ ਇੰਡੀਆ ਦੇ ਵਿੱਚ ਪੰਜਾਬ 'ਤੇ ਰਾਜ ਸੀਗਾ ਅੰਗਰੇਜ਼ਾਂ ਦਾ ਅਤੇ ਉਹ ਅੰਗਰੇਜ਼ ਤਾਂ ਚਲੇ ਗਏ ਇੰਗਲਿਸ਼ ਨੂੰ ਛੱਡ ਗਏ ਉਹ ਪ੍ਰਭਾਵਿਤ ਹੋਈ ਪੰਜਾਬੀ ਭਾਸ਼ਾ ਅਤੇ ਉਸ ਤੋਂ ਬਾਅਦ ਬਾਕੀ ਹਿੰਦੁਸਤਾਨ ਦੀ ਹਿੰਦੀ ਭਾਸ਼ਾ ਨੇ ਵੀ ਪੰਜਾਬੀ ਨੂੰ ਪ੍ਰਭਾਵਿਤ ਕੀਤਾ ਪਰ ਹਾਂ ਵਜੂਦ ਇਹ ਹੈ ਕਿ ਹਰੇਕ ਬੰਦਾ ਇੰਗਲਿਸ਼ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦਾ ਪੰਜਾਬੀ ਨੂੰ ਭੁੱਲ ਰਿਹਾ ਪ੍ਰਭਾਵਿਤ ਹੋਈ ਹੈ ਪੰਜਾਬੀ ਭਾਸ਼ਾ